ਬਿਜਲੀ ਦੇ ਬਹੁਤ ਜ਼ਿਆਦਾ ਖ਼ਤਰੇ ਨੇ ਕਦੇ ਵੀ ਬਿਜਲੀ ਦੇ ਯੰਤਰਾਂ ਨੂੰ ਠੀਕ ਕਰਨ ਲਈ ਜਾਂ ਬਿਜਲੀ ਦੇ ਯੰਤਰਾਂ ਨੂੰ ਸੰਭਾਲਣ ਲਈ ਉਹਨਾਂ ਦੇ ਬਿਜਲੀ ਦੇ ਸਰਕਟਾਂ ਤੋਂ ਬਚਣ ਲਈ ਨੰਗੇ ਹੱਥਾਂ ਦੇ ਨਾਲ ਜਾਂ ਨੰਗੀਆਂ ਤਾਰਾਂ ਨੂੰ ਨਹੀਂ ਛੂਹਣਾ ਚਾਹੀਦਾ ਖ਼ਾਸ ਕਰਕੇ ਜਦੋਂ ਕਿਤੇ ਬਿਜਲੀ ਦੇ ਨਾਲ ਸੋਰ ਸਰ ਸੋਰਟ ਸਰਕਟ ਦੇ ਨਾਲ ਕੋਈ ਅੱਗ ਲੱਗ ਜਾਵੇ ਜਾਂ ਕਿਤੇ ਨੰਗੀਆਂ ਤਾਰਾਂ ਹੋਣ ਉਹਨਾਂ 'ਤੇ ਪਾਣੀ ਜਾਂ ਪਾਣੀ ਦੇ ਨਾਲ਼ ਕਦੇ ਵੀ ਅੱਗ ਨੂੰ ਨਹੀਂ ਬੁਝਾਉਣਾ ਚਾਹੀਦਾ ਕਦੇ ਵੀ ਨੰਗੇ ਹੱਥਾਂ ਦੇ ਨਾਲ਼ ਜਾਂ ਬਿਨਾ ਦਸਤਾਨੇ ਪਹਿਨੇ ਬਿਜਲੀ ਦੇ ਯੰਤਰਾਂ ਜਾਂ ਬਿਜਲੀ ਦੀਆਂ ਨੰਗੀਆਂ ਤਾਰਾਂ ਨੂੰ ਨਹੀਂ ਟੱਚ ਕਰਨਾ ਚਾਹੀਦਾ